ਮੈਂ ਪਿਛਲੇ ਹਫ਼ਤੇ ਸੈਕਟਰ ਬਾਈ ਦੀ ਮਾਰਕਿਟ ਚੰਡੀਗੜ੍ਹ ਤੋਂ ਇੱਕ ਸੈਮਸੰਗ ਦਾ ਫ਼ੋਨ ਲਿਆ ਸੀ ਮੇਰਾ ਇਹ ਫੋਨ ਬਹੁਤ ਹੀ ਵਧੀਆ ਨਿਕਲਿਆ ਇਸ ਦਾ ਕੈਮਰਾ ਬਹੁਤ ਹੀ ਜ਼ਿਆਦਾ ਸਾਫ਼ ਹੈ ਅਤੇ ਇਸ ਦੇ ਫਰੰਟ ਕੈਮਰੇ ਦੀ ਫੋਟੋ ਬਹੁਤ ਸਾਫ਼ ਆਉਂਦੀ ਹੈ ਇਸ ਦਾ ਬੈਟਰੀ ਬੈਕਅੱਪ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਕਾਰਨ ਇਸਨੂੰ ਘੱਟ ਚਾਰਜ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਇਸਦੀ ਰੈਮ ਅੱਠ ਜੀ ਬੀ ਹੈ ਜਿਸ ਕਾਰਨ ਇਹ ਹੈਂਗ ਨਹੀਂ ਹੁੰਦਾ ਅਤੇ ਇਸਦੀ ਸਟੋਰੇਜ਼ ਵੀ ਇੱਕ ਸੌ ਅਠਾਈ ਜੀ ਬੀ ਹੈ ਜਿਸ ਕਾਰਨ ਮੈਨੂੰ ਆਪਣਾ ਡਾਟਾ ਸਟੋਰ ਕਰਨਾ ਆਸਾਨ ਹੋ ਗਿਆ ਮੈਂ ਆਪਣੇ ਫੋਨ ਤੋਂ ਬਹੁਤ ਖੁਸ਼ ਹਾਂ ਇਹ ਫੋਨ ਬਹੁਤ ਹੀ ਵਧੀਆ ਨਿਕਲਿਆ ਮੈਂ ਆਪਣੇ ਯਾਰ ਦੋਸਤ ਨੂੰ ਬੋਲਿਆ ਕਿ ਹਾਂ ਤੂੰ ਵੀ ਲੈ ਲੈ ਫੋਨ ਅਤੇ ਇੱਕ ਫੋਨ ਫੇਰ ਮੈਂ ਥੋੜ੍ਹੇ ਦਿਨ ਜਾ ਕੇ ਉਸਨੂੰ ਵੀ ਦਵਾ ਕੇ ਲੈ ਕੇ ਆਇਆ ਉਸਦਾ ਫੋਨ ਵੀ ਬਹੁਤ ਵਧੀਆ ਚੱਲ ਰਿਹਾ ਹੈ